ਇੱਕ ਵਾਰ ਸੱਤਵੀਂ ਜਮਾਤ ਦੀ ਗੱਲ ਹੈ ਮੈਂ ਬਿਨਾਂ ਆਪਦੇ ਘਰਦਿਆਂ ਨੂੰ ਦੱਸੇ ਚੰਗੀ ਤਰ੍ਹਾਂ ਤਿਆਰ ਹੋ ਕੇ ਬਣ ਠਣ ਕੇ ਆਪਣੇ ਸਕੂਲ ਦੇ ਵਿੱਚ ਚਲਾ ਗਿਆ ਅਤੇ ਸਕੂਲ ਤੋਂ ਅਸੀਂ ਕੋਲਜ ਜਾਣਾ ਸੀਗਾ ਸਕੂਲ ਦਾ ਜਿਹੜਾ ਫ਼ੈਸਟੀਵਲ ਸੀਗਾ ਉਹ ਕੋਲਜ ਦੇ ਵਿੱਚ ਹੋ ਰਿਹਾ ਸੀ ਅਤੇ ਅਸੀਂ ਕੋਲਜ ਚਲੇ ਗਏ ਘਰ ਮੇਰੇ ਘਰਦਿਆਂ ਨੂੰ ਬਿਲਕੁਲ ਨਹੀਂ ਪਤਾ ਸੀ ਕਿ ਮੈਂ ਕਿੱਥੇ ਗਿਆ ਹਾਂ ਅਤੇ ਉਹ ਵੀ ਮੈਂ ਗੱਡੀ ਚੱਕ ਕੇ ਬਿਨਾਂ ਦੱਸੇ ਚਲਾ ਗਿਆ ਸੀ ਅਤੇ ਸਕੂਲ ਦੇ ਵਿੱਚ ਜਾ ਕੇ ਜਦੋਂ ਅਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਮੈਂ ਖੇਡਿਆ ਯਾਰਾਂ ਦੋਸਤਾਂ ਦੇ ਨਾਲ ਅਸੀਂ ਇਨਜੋਏ ਕੀਤਾ ਪਾਰਟੀ ਕੀਤੀ ਨੱਚੇ ਟੱਪੇ ਅਤੇ ਨੱਚਦੇ ਟੱਪਦੇ ਜੇ ਕਦੋਂ ਟਾਇਮ ਲੰਘ ਗਿਆ ਬਿਲਕੁਲ ਪਤਾ ਹੀ ਨਹੀਂ ਚੱਲਿਆ ਛੇ ਤੋਂ ਕਦੋਂ ਨੌਂ ਵੱਜ ਗਏ ਨੌਂ ਤੋਂ ਕਦੋਂ ਗਿਆਰ੍ਹਾਂ ਵੱਜ ਗਏ ਅਤੇ ਗਿਆਰ੍ਹਾਂ ਕੁ ਵਜੇ ਜਦ ਅਸੀਂ ਜਦ ਅਸੀਂ ਸਕੂਲ ਤੋਂ ਨਿਕਲੇ ਕੋਲਜ ਤੋਂ ਨਿਕਲੇ ਕਿਉਂਕਿ ਕੋਲਜ ਦੇ ਵਿੱਚ ਸਾਡੀ ਪਾਰਟੀ ਸੀਗੀ ਜਿਹੜਾ ਫੈਸਟੀਵਲ ਸੀਗਾ ਅਤੇ ਉੱਥੋਂ ਦੇ ਨਿਕਲਦੇ ਸਾਰ ਅਸੀਂ ਜਦ ਬਾਹਰ ਸੜਕ 'ਤੇ ਨਿਕਲੇ ਤਾਂ ਨਾਕੇ ਲੱਗੇ ਹੋਏ ਸੀ ਪੁਲਿਸ ਦੇ ਉਮਰ ਮੇਰੀ ਓਦੋਂ ਸੋਲ਼੍ਹਾਂ ਕੁ ਸਾਲ ਸੀਗੀ ਅਤੇ ਲਾਇਸੰਸ ਮੇਰੇ ਕੋਲ ਸੀਗਾ ਨਹੀਂ ਅਤੇ ਮੈਂ ਬੜੀ ਔਖੇ ਬਚਦਾ ਬਚਾਉਂਦਾ ਘਰ ਪੁੁੱਜਿਆ ਅਤੇ ਘਰ ਜਾ ਕੇ ਮੈਂ ਆਪਣੇ ਮਾਪਿਆਂ ਤੋਂ ਇੱਕੋ ਗੱਲ ਕਹੀ ਬੜੇ ਪਿਆਰ ਨਾਲ ਬੜੇ ਲਹਿਜੇ ਦੇ ਨਾਲ ਕਿ ਅੱਜ ਤੋਂ ਬਾਅਦ ਮੈਂ ਬਿਨਾਂ ਦੱਸੇ ਕਿਤੇ ਵੀ ਨਹੀਂ ਜਾਉਂਗਾ ਮੈਂ ਤੁਹਾਡੀ ਹਰ ਗੱਲ ਦੀ ਪਾਲਣਾ ਕਰਾਂਗਾਂ ਸਿਆਣੇ ਬੱਚਿਆਂ ਵਾਂਗ ਗੱਲ ਕਰਾਂਗਾ